ਹਰੇਕ ਸੱਭਿਆਚਾਰ 'ਤੇ ਸਮੇਂ ਦੇ ਨਾਲ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਸਥਿਤੀਆਂ ਦਾ ਪੰਜਾਬੀ ਸੱਭਿਆਚਾਰ 'ਚ ਅਸੀਂ ਦੇਖਦੇ ਹਾਂ ਕਿ ਪੰਜਾਬੀ ਪਹਿਰਾਵਾ ਹੋ ਗਿਆ ਪੰਜਾਬੀ ਗਹਿਣੇ ਹੋ ਗਏ ਪੰਜਾਬੀ ਖਾਣ ਪੀਣ ਹੋ ਗਿਆ ਪੰਜਾਬੀ ਸੱਭਿਆਚਾਰ ਇਹ ਸਾਰਾ ਕੁਝ ਬਦਲ ਰਿਹਾ ਗਾ ਅਤੇ ਜਿਵੇਂ ਅਸੀਂ ਪ੍ਰਾਚੀਨ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਸਾਡੇ ਗਹਿਣਿਆਂ ਦੇ ਬਹੁਤ ਜ਼ਿਆਦਾ ਰੂਪ ਸੀਗੇ ਜਿਵੇਂ ਕੰਨਾਂ ਦੇ ਵਿੱਚ ਬਹੁਤ ਜ਼ਿਆਦੇ ਜਿਵੇਂ ਪਿੱਪਲ ਪੱਤੀਆਂ ਹੋ ਗਈਆਂ ਵਾਲੀਆਂ ਹੋ ਗਈਆਂ ਮੁਰਕੀਆਂ ਹੋ ਗਈਆਂ ਅਤੇ ਮੁੰਦਰਾਂ ਹੋ ਗਈਆਂ ਇਹ ਸਾਰੇ ਰੂਪ ਸੀ ਗਰਦਨ ਦੇ ਵਿੱਚ ਬਹੁਤ ਸਾਰੇ ਗਹਿਣਿਆਂ ਦੇ ਸਾਡੇ ਕੋਲ ਰੂਪ ਗਹਿਣਿਆਂ ਦੇ ਵੱਖਰੇ ਵੱਖਰੇ ਤਰੀਕਿਆਂ ਦੇ ਗਹਿਣੇ ਪਾਏ ਜਾਂਦੇ ਸੀ ਨੱਕ ਦੇ ਵਿੱਚ ਪਾਏ ਜਾਂਦੇ ਸੀ ਤਾਂ ਅੱਜ ਦੇ ਸਮੇਂ ਦੇ ਵਿੱਚ ਆਧੁਨਿਕ ਯੁੱਗ ਦੇ ਪ੍ਰਭਾਵ ਕਾਰਨ ਜਿਹੜੀਆਂ ਸਾਡੇ ਗਹਿਣੇ ਉਹਨਾਂ ਦਾ ਰੂਪ ਬਿਲਕੁਲ ਹੀ ਬਦਲ ਚੁੱਕਿਆ ਗਾ ਕੁਝ ਗਹਿਣੇ ਤਾਂ ਅਜਿਹੇ ਹੈ ਕਿ ਜਿਹੜੇ ਬਿਲਕੁਲ ਹੀ ਅਲੋਪ ਹੋ ਚੁੱਕੇ ਹਨ ਜਿਹੜੇ ਕਿ ਅੱਜ ਦੇ ਸਮੇਂ ਦੇ ਵਿੱਚ ਪਹਿਨੇ ਨਹੀਂ ਜਾਂਦੇ ਗੇ ਪਰੰਤੂ ਕੁਝ ਜਿਹੜੇ ਬਚੇ ਹੋਏ ਹਨ ਉਹਨਾਂ ਦਾ ਜਿਹੜਾ ਨਵਾਂ ਰੂਪ ਆ ਜਦ ਤੱਕ ਨ ਜਾਂ ਪਦਾਰਥਵਾਦੀ ਯੁੱਗ ਦੇ ਕਾਰਨ ਮੰਡੀਕਰਨ ਦੇ ਪ੍ਰਭਾਵ ਕਾਰਨ ਉਹਨਾਂ ਦਾ ਬਿਲਕੁਲ ਨਵਾਂ ਰੂਪ ਸਾਡੇ ਸਾਹਮਣੇ ਆ ਰਿਹਾ ਹੈਗਾ ਅਤੇ ਪ੍ਰਾਚੀਨ ਰੂਪ ਆ ਜਿਹੜਾ ਉਹਨਾਂ ਦਾ ਖਤਮ ਹੋ ਰਿਹਾ ਅਤੇ